ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਸਿਖਾਉਣ ਲਈ ਕਈ ਤਰੀਕੇ ਹੁੰਦੇ ਹਨ ਜਿੰਨ੍ਹਾਂ ਵਿੱਚ ਕਲਾ ਦੀ ਨਿਕਟਤਾ ਦੀ ਯਾਤਰਾਵਾਂ ਕਲਾ ਨੂੰ ਲਿਖਣ ਅਤੇ ਅਨੁਭਵ ਕਰਨ ਦੇ ਮੌਕੇ ਆਦਿ ਕਈ ਹੋਰ ਤਰੀਕੇ ਮਿਲਦੇ ਹਨ ਇਨ੍ਹਾਂ ਤਰੀਕਿਆਂ ਨਾਲ ਵਿਦਿਆਰਥੀ ਨਾਲ ਕਲਾ ਅਤੇ ਸ਼ਿਲਪਕਾਰੀ ਨੂੰ ਇੱਕ ਗਹਿਰਾ ਸੰਬੰਧ ਵਿਕਸਿਤ ਹੋ ਜਾਂਦਾ ਹੈ ਅਤੇ ਉਹਨਾਂ ਦੀ ਰਚਨਾਤਮਕਤਾ ਨੂੰ ਪ੍ਰੋਤਸਾਹਨ ਮਿਲਦਾ ਹੈ ਹਾਂ ਮੇਰੇ ਕੋਲ ਕਲਾ ਅਤੇ ਸ਼ਿਲਪਕਾਰੀ ਨਾਲ ਸੰਬੰਧਿਤ ਕਈ ਯਾਦਾਂ ਹਨ ਮੇਰੇ ਬਚਪਨ ਉੱਤੇ ਪਿਤਾ ਜੀ ਮੈਨੂੰ ਸ਼ਿਲਪ ਅਤੇ ਕਲਾ ਵਿੱਚ ਦਲੇਰਾ ਹੋਣ ਦਾ ਸੰਘਰਸ਼ ਵੇਖਣ ਨੂੰ ਮਿਲਦਾ ਸੀ ਉਹ ਮੇਰੇ ਲਈ ਪ੍ਰੇਰਨਾ ਸੀ ਅਤੇ ਮੈਨੂੰ ਕਲਾ ਨੂੰ ਸਮਝਣ ਅਤੇ ਵਿਕਾਸ ਕਰਨ ਵਿੱਚ ਮਦਦ ਮਿਲਦੀ ਹੈ ਮੈਂ ਸਕੂਲ ਵਿੱਚ ਕਲਾ ਦੇ ਵਿਭਿੰਨ ਪ੍ਰੋਜੈਕਟਾਂ ਵਿੱਚ ਭਾਗ ਲਿਆ ਹੈ ਜਿਸ ਕਰਕੇ ਮੇਰਾ ਬਚਪਨ ਕਲਾ ਅਤੇ ਸ਼ਿਲਪਕਾਰੀ ਨਾਲ ਗੂੜ੍ਹ ਜੁੜ੍ਹਿਆ ਹੋਇਆ ਹੈ